ਜੇਕਰ ਆਵਾਜਾਈ ਦੀ ਗੱਲ ਕਰੀ ਜਾਵੇ ਤਾਂ ਆਵਾਜਾਈ ਸੰਬੰਧੀ ਕਾਫ਼ੀ ਚੁਣੌਤੀਆਂ ਪੇਸ਼ ਹੁੰਦੀਆਂ ਹਨ ਪਿੰਡਾਂ ਪੇਂਡੂ ਖੇਤਰ ਵਿੱਚ ਤਾਂ ਬਹੁਤ ਜ਼ਿਆਦਾ ਚੁਣੌਤੀਆਂ ਹਨ ਕਿਉਂਕਿ ਉੱਥੇ ਸਾਧਨ ਹੀ ਬਹੁਤ ਘੱਟ ਹਨ ਆਵਾਜਾਈ ਦੇ ਜੇਕਰ ਬੱਸਾਂ ਦੀ ਗੱਲ ਕਰੀ ਜਾਵੇ ਤਾਂ ਪੇਂਡੂ ਖੇਤਰਾਂ ਵਿੱਚ ਬਹੁਤ ਘੱਟ ਬੱਸਾਂ ਚੱਲਦੀਆਂ ਹਨ ਪਹਿਲਾਂ ਤਾਂ ਬੱਸ ਹੀ ਟਾਇਮ 'ਤੇ ਨਹੀਂ ਆਉਂਦੀ ਜੇ ਕੋਈ ਬੱਸ ਟਾਇਮ 'ਤੇ ਆਉਂਦੀ ਹੈ ਤਾਂ ਫਿਰ ਉਹ ਉਸ ਓਦਾਂ ਹੀ ਪੂਰੀ ਭਰੀ ਹੁੰਦੀ ਹੈ ਸੀਟ ਨਹੀਂ ਕਿਸੇ ਨੂੰ ਮਿਲਦੀ ਤਾਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਜਾਂ ਫਿਰ ਔਰਤਾਂ ਨੂੰ ਕਾਫ਼ੀ ਪਰੇਸ਼ਾਨੀ ਆਉਂਦੀ ਹੈ ਅਤੇ ਫਿਰ ਉਸ ਤੋਂ ਬਾਅਦ ਫਿਰ ਜੋ ਕੰਡਕਟਰ ਹੁੰਦਾ ਹੈ ਉਸਦਾ ਬਿਹੇਵੀਅਰ ਵੀ ਫਿਰ ਕਾਫ਼ੀ ਹੋਰ ਤਰ੍ਹਾਂ ਦਾ ਹੁੰਦਾ ਹੈ ਤਾਂ ਇਹ ਇੱਕ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਜੋ ਕਿ ਪੇਂਡੂ ਖੇਤਰਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਜੇ ਸੜਕਾਂ ਦੀ ਗੱਲ ਕਰੀ ਜਾਵੇ ਤਾਂ ਸੜਕਾਂ ਵੀ ਕਾਫ਼ੀ ਬੁਰਾ ਹਾਲ ਹੈ ਸੜਕਾਂ ਦਾ ਵੀ ਖੱਡੇ ਪਏ ਹੋਏ ਹਨ ਕੋਈ ਸ ਗੋਰਮੈਂਟ ਸਰਕਾਰ ਪੁੱਛ ਹੀ ਨਹੀਂ ਕੁਛ ਤਾਂ ਇਸ ਤਰ੍ਹਾਂ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹਨਾਂ ਚੁਣੌਤੀਆਂ ਨੂੰ ਦੂਰ ਕਰਨ ਲਈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਇਸ ਖੇਤਰ ਵੱਲ ਵੀ ਵੱਧ ਤੋਂ ਵੱਧ ਆਵਾਜਾਈ ਦਾ ਵਿਕਾਸ ਕਰਨਾ ਚਾਹੀਦਾ ਹੈ ਜਿਸ ਨਾਲ਼ ਕਿ ਲੋਕਾਂ ਨੂੰ ਪ੍ਰੇਸ਼ਾਨੀ ਨਾ ਆਵੇ